ਹੈਲੋ ਨਮਸਤੇ ਜੀ ਮੈਂ ਜੀ ਨੈਨਸੀ ਬੋਲਦੀ ਹਾਂ ਮੈਮ ਤੁਹਾਡਾ ਨੰਬਰ ਨਾ ਮੇਰੀ ਸਹੇਲੀ ਨੇ ਦਿੱਤਾ ਸੀ ਜੀ ਮੈਂ ਨਾ ਚੰਡੀਗੜ੍ਹ ਦੀ ਹਾਂ ਮੈਂ ਨਾ ਘੁੰਮਣ ਆਉਣਾ ਸੀ ਜੀ ਦੱਸੋ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਉਥੇ ਕਿਹੜੇ ਕਿਹੜੇ ਪਾਰਕ ਹੈ ਹੈਂਜੀ ਹਾਂਜੀ ਅੱਛਾ ਜੀ ਜੀ ਤੁਸੀਂ ਜਾਂਦੇ ਹੋ ਉੱਥੇ ਅੱਛਾ ਜੀ ਉੱਥੇ ਕਿਆ ਕਿਆ ਹੈ ਜੀ ਹਾਂਜੀ ਹਾਂਜੀ ਮੈਂ ਜੀ ਇੱਕ ਤਰੀਕ ਨੂੰ ਆਉਣਾ ਹੈ ਮੈਂ ਜੀ ਟੈਕਸੀ 'ਚ ਆਉਣਾ ਜੀ ਹਾਂਜੀ ਠੀਕ ਹੈ ਜੀ ਕੋਈ ਨਾ ਮੈਂ ਤੁਹਾਨੂੰ ਇੱਕ ਦਿਨ ਪਹਿਲਾਂ ਫੋਨ ਜਾਂ ਮੈਸੇਜ ਕਰ ਦਉਂਗੀ ਹਾਂਜੀ ਠੀਕ ਹੈ ਜੀ ਮੇਰੇ ਕੋਲ ਤੁਹਾਡਾ ਵਟਸਐਪ ਨੰਬਰ ਆ ਗਿਆ ਜੀ ਫਿਰ ਮੈਂ ਤੁਹਾਨੂੰ ਮੈਸੇਜ ਜਾਂ ਫਿਰ ਮੈਂ ਕੋਲ ਕਰ ਲਉਂਗੀ

ਅੱਛਾ ਜੀ ਕੋਈ ਨਾ ਜੀ